ਖੇਤੀਬਾੜੀ ਕਰਨ ਲਈ ਕਈ ਤਰ੍ਹਾਂ ਦੇ ਅਲੱਗ ਅਲੱਗ ਸਾਧਨ ਵਰਤੇ ਜਾਂਦੇ ਹਨ ਜਿਵੇਂ ਕਿ ਕਹੀ ਦਾ ਉਪਯੋਗ ਕੀਤਾ ਜਾਂਦਾ ਕਹੀ ਦਾ ਉਪਯੋਗ ਇੱਕ ਥਾਂ ਤੋਂ ਮਿੱਟੀ ਦੂਜੀ ਜਗ੍ਹਾ ਚੱਕ ਕੇ ਰੱਖਣ ਲਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾਤਰੀ ਦਾ ਉਪਯੋਗ ਕੀਤਾ ਜਾਂਦਾ ਹੈ ਦਾਤਰੀ ਪੱਠੇ ਵੱਢਣ ਲਈ ਜਾਂ ਕੁਛ ਚੀਜ਼ ਘਾਹ ਕਣਕ ਵੱਢਣ ਲਈ ਉਪਯੋਗ ਕੀਤਾ ਜਾਂਦਾ ਹੈ ਖੁਰਪੇ ਦਾ ਇਸਤੇਮਾਲ ਹੁੰਦਾ ਹੈ ਖੁਰਪੇ ਨਾਲ ਛੋਟੀ ਜਗ੍ਹਾ 'ਤੇ ਬੂਟੇ ਲਗਾਉਣ ਲਈ ਜਾਂ ਛੋਟਾ ਘਾਹ ਵੱਡਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਟਰੈਕਟਰ ਦੇ ਨਾਲ਼ ਫਾਲ਼ੇ ਆ ਫਾਲ਼ਿਆਂ ਦਾ ਇਸਤੇਮਾਲ ਅਸੀਂ ਖੇਤ ਵਾਹੁਣ ਲਈ ਕਰਦੇ ਹਾਂ